ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹਾਂਜੀ ਹੋਰ ਬਸ ਠੀਕ ਹੈ ਤੁਸੀਂ ਸੁਣਾਓ ਹਾਂਜੀ ਉਹ ਤਾਂ ਹੈ ਹੀ ਅੱਜ ਕੱਲ੍ਹ ਇੰਨੀ ਐਜੂਕੇਸ਼ਨ ਲੈ ਕੇ ਕੋਈ ਫ਼ਾਇਦਾ ਹੀ ਨਹੀਂ ਹੈ ਘਰ ਹੀ ਬੈਠੇ ਨੇ ਸਾਰੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਠੀਕ ਆ ਅਸੀਂ ਵੀ ਇੰਨਾ ਇੰਨੀ ਐਜੂਕੇਸ਼ਨ ਲੈ ਕੇ ਘਰ ਹੀ ਬੈਠੇ ਦੇ ਹਾਂ ਹਾਂਜੀ ਹਾਂਜੀ ਟੈਸਟ ਨਹੀਂ ਕਲੀਅਰ ਹੁੰਦੇ ਅੱਜ ਕੱਲ੍ਹ ਦੇ ਨੌਕਰੀ ਕਿੱਥੋਂ ਮਿਲਣੀ ਗੌਰਮੈਂਟ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਹੋਰ ਤੁਹਾਡੇ ਬੱਚੇ ਸਟੈਂਡ ਹੈਗੇ ਆ ਜੋਬ ਵਗੈਰਾ ਕਰਦੇ ਆ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਇੰਨੇ ਪੈਸੇ ਵੀ ਖਰਚੇ ਧੰਨਵਾਦ ਜੀ